ਸਤਿ ਸ਼੍ਰੀ ਅਕਾਲ ਜੀ ਦੇਖੋ ਅੱਜ ਦਾ ਜਿਹੜਾ ਯੁੱਗ ਹੈ ਉਹ ਡਿਜੀਟਲ ਯੁੱਗ ਹੈ ਅਤੇ ਜੇਕਰ ਦੁਨੀਆਂ ਦੇ ਵਿੱਚ ਅਸੀਂ ਭਾਰਤ ਦੀ ਕਲਾ ਅਤੇ ਕਲਾਕਾਰ ਦੀ ਪ੍ਰਤੀਨਿਧ ਨਿਧਤਾ ਵਧਾਉਣੀ ਹੈ ਤਾਂ ਡਿਜੀਟਲਲਾਈਜੇਸ਼ਨ ਹੀ ਇੱਕੋ ਇੱਕ ਮਾਧਿਅਮ ਹੈ ਜਿਹਦੇ ਨਾਲ ਭਾਰਤੀ ਕਲਾ ਨੂੰ ਦੁਨੀਆਂ ਪੱਧਰ 'ਤੇ ਲਿਆਉਂਦਾ ਜਾ ਸਕਦਾ ਹੈ ਭਾਰਤ ਦੇ ਵਿੱਚ ਕਲਾ ਦੇ ਬੇਮਿਸਾਲ ਸ ਸਰੋਤ ਨੇ ਇੱਥੇ ਬਹੁਤ ਸਾਰੇ ਕਲਾਕਾਰ ਨੇ ਜੋ ਕਿ ਆਪਣੀ ਪੁਰਾਣੀ ਕਲਾਵਾਂ ਨੂੰ ਸਾਂਭੇ ਹੋਏ ਨੇ ਉਹਨਾਂ ਦੀ ਰੀਸ ਕੋਈ ਨਹੀਂ ਕਰ ਸਕਦਾ ਹਾਂ ਹਾਲਾਂਕੀ ਹੁਣ ਹਜੇ ਕਲਾ ਦੇ ਖੇਤਰ ਦੇ ਵਿੱਚ ਡਿਜੀਟਲ ਡਿਜੀਟਲਾਈਜੇਸ਼ਨ ਨੇ ਬਹੁਤ ਈ ਜ਼ਿਆਦਾ ਪ੍ਰਭਾਵ ਪਾਇਆ ਹੈ ਪਹਿਲਾਂ ਲੋਕਾਂ ਦੀ ਜਿਹੜੀ ਕਲਾ ਸੀ ਉਹ ਉਹਨਾਂ ਦੇ ਏਰੀਆ ਤੱਕ ਈ ਸੀਮਤ ਰਹਿ ਜਾਂਦੀ ਸੀ ਪਰ ਅੱਜ ਕੱਲ੍ਹ ਮੋਬਾਈਲ ਦਾ ਯੁੱਗ ਹੈ ਅਪ ਲੋਕ ਆਪਣੀ ਕਲਾ ਦਾ ਪ੍ਰਸ਼ ਪ੍ਰਦਰਸ਼ਨ ਓਨਲਾਈਨ ਕਰ ਸਕਦੇ ਹਨ ਅਤੇ ਇਹ ਕਲਾ ਦੁਨੀਆਂ ਦੇ ਏਮ ਭਾਰਤ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਦੇ ਵਿੱਚ ਆਰਾਮ ਨਾਲ ਪਹੁੰਚ ਜਾਂਦੀ ਹੈ ਅਤੇ ਇਸ ਤਰੀਕੇ ਨਾਲ ਉਸ ਕਲਾ ਨੂੰ ਪ੍ਰਮਾਣ ਮਿਲਦਾ ਹੈ ਇੱਕ ਜ਼ਰੀਆ ਮਿਲਦਾ ਹੈ ਜਿਹਦੇ ਨਾਲ ਉਹਦੀ ਪਹਿਚਾਨ ਹੋ ਸਕਦੀ ਹੈ ਧੰਨਵਾਦ